ਬੱਚਿਆਂ ਨੂੰ ਆਪਣਾ ਖਾਤਾ ਖੋਲ੍ਹਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਹਾਂ ਉਹਦੀ ਭੂਤ ਮੱਤ ਹੁੰਦੀ ਹੈ ਜਿਹੜੇ ਬੱਚੇ ਆ ਉਹ ਜਿੰਨੇ ਪੈਸੇ ਜਿੰਨੇ ਪੈਸੇ ਆਉਂਦੇ ਉਹ ਸੋਚਦੇ ਕਿ ਮੈਂ ਇਹ ਖਰੀਦ ਲਾਂ ਇਹ ਖਰੀਦ ਲਾਂ ਸਾਨੂੰ ਬਚਪਨ ਤੋਂ ਹੀ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਆਪਣੀ ਜਿਹੜੀ ਰਾਸ਼ੀ ਆ ਉਹ ਤੁਸੀਂ ਜਮ੍ਹਾਂ ਕਰੋ ਆਪਣੇ ਬੈਂਕ 'ਚ ਪਾਓ ਉਹ ਕੱਲ੍ਹ ਨੂੰ ਤੁਹਾਡੇ ਕੰਮ ਆਉਣਗੇ ਖਰਚਾ ਵੀ ਹੁੰਦਾ ਪਰ ਖਰਚਾ ਵੀ ਇੱਕ ਹਿਸਾਬ ਦਾ ਹੁੰਦਾ ਇਸ ਕਰਕੇ ਬੱਚਤ ਖਾਤਾ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਰਾ ਉਹਨਾਂ ਦੇ ਮਾਂ ਪਿਓ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਬੱਚਤ ਖਾਤਾ ਖੁਲਵਾਈਏ ਕਿਉਂਕਿ ਬੱਚਤ ਖਾਤਾ ਬੱਚਿਆਂ ਨੂੰ ਬਹੁਤ ਇੱਕ ਤਾਂ ਸਭ ਤੋਂ ਪਹਿਲਾਂ ਉਹਨੂੰ ਜਿੰਮੇਦਾਰ ਬਣਾਏਗਾ ਉਹਨੂੰ ਸਿਖਾਏਗਾ ਕਿ ਕੱਲ੍ਹ ਨੂੰ ਤੁਸੀਂ ਪੈਸੇ ਕਿੱਦਾਂ ਅਤੇ ਕਿਉਂ ਖਰਚਣੇ ਆ ਜਿਹਨੇ ਬ ਬੱਚਾ ਇਹ ਸੋਚੇਗਾ ਕਿ ਹੁਣ ਕੱਲ੍ਹ ਨੂੰ ਪੈਸੇ ਕਿਉਂ ਔਰ ਕਿੱਦਾਂ ਖਰਚਣੇ ਆ ਤਾਂ ਉਹ ਆਪਣੀ ਜ਼ਿੰਦਗੀ 'ਚੋਂ ਕੁਛ ਕਰ ਸਕਦਾ ਬੱਚਤ ਖਾਤਾ ਇਸ ਲਈ ਬਹੁਤ ਜ਼ਰੂਰੀ ਹੈ ਅਤੇ ਹਰ ਇੱਕ ਬੱਚੇ ਦਾ ਬੱਚਤ ਖਾਤਾ ਹੋਣਾ ਬਹੁਤ ਜ਼ਰੂਰੀ ਹੈ ਬੱਚਤ ਖਾਤਾ ਕੇਵਲ ਬੱਚਤ ਲਈ ਹੀ ਨਹੀਂ ਹੋਰ ਵੀ ਸ ਬੱਚਤ ਖਾਤੇ ਨਾਲ ਬੱਚਾ ਬਹੁਤ ਕੁਛ ਖਰੀਦ ਸਕਦਾ ਹੈ ਅਤੇ ਕੱਲ੍ਹ ਨੂੰ ਉਹਨੂੰ ਔਖਾ ਵੀ ਨਹੀਂ ਹੋਵੇਗਾ